ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਅਤੇ ਔਨਲਾਈਨ ਸ਼ੋਪਿੰਗ ਦੇ ਵਿੱਚ ਮੈਂ ਐਮਾਜੋਨ ਤੋਂ ਜੋ ਵੀ ਸਮਾਨ ਮੰਗਾਉਣਾ ਗਾ ਸੋ ਇੱਕ ਵਾਰ ਮੈਂ ਹੈਡਫੋਨ ਮੰਗਾਏ ਸੀ ਐਮਾਜੋਨ ਤੋਂ ਸੋ ਦਿਵਾਲੀ ਦੇ ਦਿਨਾਂ 'ਚ ਮੰਗਾਏ ਸੀ ਅਤੇ ਉਹਨਾਂ ਦਿਨਾਂ ਦੇ ਵਿੱਚ ਔਫਰ ਚੱਲ ਰਿਹਾ ਸੀਗਾ ਉਹ ਔਫਰ ਸੀਗਾ ਇੱਕ ਹਜ਼ਾਰ ਦੇ ਰੁਪਏ ਦੇ ਵਿੱਚ ਵੀਹ ਹੈੱਡਫੋਨ ਦੇ ਰਹੇ ਸੀਗੇ ਸੋ ਪਹਿਲਾਂ ਮੈਨੂੰ ਲੱਗਿਆ ਕਿ ਇਹ ਫੇਕ ਹੋ ਸਕਦਾ ਕਿਉਂਕਿ ਐਪਲੀਕੇਸ਼ਨ ਬਹੁਤ ਫੇਕ ਵੀ ਚੱਲ ਰਹੇ ਆ ਸੋ ਮੈਂ ਉਹ ਔਡਰ ਕਰਤੇ ਪਰ ਉਹ ਇੱਕ ਓਰਿਜਨਲ ਐਪਲੀਕੇਸ਼ਨ ਦੇ ਵਿੱਚ ਔਫਰ ਸੀਗਾ ਸੋ ਮੈਂ ਉਹ ਉਹ ਚੀਜ਼ ਦੇਖਦੇ ਹੋਏ ਮੈਂ ਇਹ ਔਡਰ ਕਰਤੇ ਸੀ ਉਹਨਾਂ ਦਾ ਸਮਾਂ ਔਡਰ ਜਦੋਂ ਮੈਂ ਕੀਤੇ ਦਸ ਦਿਨਾਂ ਦਾ ਸੀਗਾ ਅਤੇ ਉਹ ਮੇਰੇ ਕੋਲ ਪੰਜ ਦਿਨਾਂ ਦੇ ਵਿੱਚ ਹੀ ਆ ਗਏ ਅਤੇ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦੇ ਹੈੱਡਫੋਨ ਸੀਗੇ ਅਤੇ ਬਹੁਤ ਹੀ ਬਹੁਤ ਹੀ ਸਸਤੇ ਰੇਟ ਦੇ ਵਿੱਚ ਪੈ ਗਏ ਮੈਨੂੰ ਅਤੇ ਬਹੁਤ ਹੀ ਇੱਕ ਵਧੀਆ ਕੁਆਲਿਟੀ ਦੇ ਕਹਿ ਸਕਦੇ ਆਪਾਂ ਉਸ ਤਰ੍ਹਾਂ ਦੇ ਦੇਖਣ ਨੂੰ ਜਾਨੀ ਕਿ ਉਹਨਾਂ ਦੀ ਲੁੱਕ ਬਹੁਤ ਹੀ ਘੈਂ ਵਧੀਆ ਸੀਗੀ ਸੋ ਇੱਕ ਉਹਨਾਂ ਦੀ ਆਵਾਜ਼ ਉਹਨਾਂ ਦੀ ਹੈੱਡ ਜਿਹੜੀ ਆਵਾਜ਼ ਹੁੰਦੀ ਹੈ ਉਹ ਬਹੁਤ ਵਧੀਆ ਸੀਗੀ ਉਹਨਾਂ ਦੇ ਹੈੱਡ ਹੈੱਡ ਦੇ ਮੈਕ ਵੀ ਬਹੁਤ ਵਧੀਆ ਸੀਗੇ ਅਤੇ